ਹਾਂਜੀ ਬੀਮਾ ਕਵਰੇਜ ਬੀਮਾ ਕਵਰੇਜ ਤਾਂ ਹਰ ਜਗ੍ਹਾ ਹੁੰਦਾ ਹੈ ਹਰ ਫੈਕਟਰੀ ਕਰਦੀ ਹੈ ਜਿਹੜੀਆਂ ਲਿਮਿਟਡ ਫੈਕਟਰੀਆਂ ਹਨ ਉੱਥੋਂ ਤੁਹਾਨੂੰ ਹਸਪਤਾਲਾਂ ਵਾਸਤੇ ਇਹ ਬੀਮੇ ਦੀ ਰਾਸ਼ੀ ਕੱਟਣ ਲਈ ਇੱਕ ਅਲੱਗ ਤੋਂ ਉਹ ਉਹ ਤੁਹਾਨੂੰ ਆਪਣਾ ਉਹ ਉਹਦਾ ਕੁਛ ਹਿੱਸਾ ਆਪਣੇ ਪੇਮੈਂਟ ਦਾ ਆਪਣੀ ਸੈਲਰੀ ਦਾ ਦੇਣਾ ਪੈਂਦਾ ਹੈ ਅਤੇ ਉਹਦੇ ਨਾਲ ਤੁਹਾਨੂੰ ਇਹ ਇਹ ਜਿਹੜੀ ਕਵਰੇਜ ਹੈ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਉਹਦਾ ਖਰਚਾ ਜਿਹੜਾ ਹੈਗਾ ਵਾ ਉਹ ਹਸਪਤਾਲਾਂ ਦਾ ਉਹ ਮਿਲ ਜਾਂਦਾ ਹੈ ਅਤੇ ਉਹ ਜਾ ਕੇ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਵਿਘਨ ਤਾਂ ਆਉਂਦੀਆਂ ਹਨ ਬਹੁਤ ਫਸਲ ਅ ਜਿਹੜੀਆਂ ਹਨ ਉਹ ਕਰਨੀਆਂ ਪੈਂਦੀਆਂ ਹਨ ਫੋਰਮੈਲਟੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਕਈ ਤਰ੍ਹਾਂ ਦੇ ਕਾਗਜ਼ੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਇਹ ਬੀਮਾ ਵੈਸੇ ਤਾਂ ਮਿਲ ਹੀ ਜਾਂਦਾ ਹੈ ਐਸੀ ਗੱਲ ਨਹੀਂ ਹੈ ਲੇਕਿਨ ਉਹਦੇ ਵਿੱਚ ਬਹੁਤ ਹੀ ਪਰੇਸ਼ਾਨੀਆਂ ਬਹੁਤ ਚੁਗਣੀਆਂ ਪੈਂਦੀਆਂ ਹਨ ਆਮ ਆਦਮੀ ਨੂੰ ਅਤੇ ਇਹ ਜਿਹੜਾ ਬੀਮਾ ਹੈਗਾ ਹੈ ਸਰਕਾਰ ਵੱਲੋਂ ਵੀ ਇਸ ਦੇ ਲਾਭ ਵਾਸਤੇ ਬਹੁਤ ਹੀ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਉਹ ਜਨ ਧਨ ਯੋਜਨਾ ਅਤੇ ਆਪਣਾ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਹੈਗੀਆਂ ਹਨ ਜਿਨ੍ਹਾਂ ਦੇ ਨਾਲ ਤੁਸੀਂ ਜਿਸ ਤਰ੍ਹਾਂ ਪੰਜ ਲੱਖ ਦਾ ਜਾਂ ਦੋ ਲੱਖ ਦੇ ਜਾਂ ਤਿੰਨ ਲੱਖ ਦਾ ਬੀਮਾ ਕਰਵਾ ਲੈਂਦੇ ਹੋ ਤਾਂ ਉਹ ਜਾ ਕੇ ਜਿਸ ਹੋਸਪਿਟਲ ਦੇ ਵਿੱਚ ਇਸ ਦੀ ਪ੍ਰਤੀਕ੍ਰਿਆ ਚੱਲਦੀ ਹੋਵੇ ਉੱਥੇ ਜਾ ਕੇ ਤੁਸੀਂ ਦੱਸ ਸਕਦੇ ਹੋ ਅਤੇ ਉੱਥੋਂ ਦੀ ਤੁਹਾਨੂੰ ਉਹ ਉਸ ਹਸਪਤਾਲ ਦਾ ਟਰੀਟਮੈਂਟ ਹੈਗਾ ਵਾ ਉਹ ਉਸ ਬੀਮੇ ਦੇ ਰਾਹੀਂ ਤੁਹਾਨੂੰ ਉਹ ਕਰ ਦਿੱਤਾ ਜਾਂਦਾ ਹੈ ਅਤੇ ਉਹ ਪਰ ਇਸ ਦੇ ਲਈ ਵਿਘਨ ਤਾਂ ਪੈਂਦੇ ਹੀ ਹਨ ਬਹੁਤ ਫੈਸਿਲਿਟੀਆਜ਼ ਬੋ ਹੈਗੀਆਂ ਦਿੱਤੀਆਂ ਨੇ ਗੌਰਮੈਂਟ ਨੇ ਪਰ ਵਿਘਨ ਤਾਂ ਬਹੁਤ ਤਰ੍ਹਾਂ ਦੇ ਪੈਂਦੇ ਹਨ